ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੋਣ ਜੀ ਅਸੀਂ ਨਾ ਇੱਥੇ ਤੁਹਾਡੀ ਗਲੀ ਦੇ ਵਿੱਚ ਰਹਿੰਦੇ ਹਾਂ ਉਹ ਤੁਹਾਡੇ ਬੱਚੇ ਜਾਂਦੇ ਨੇ ਸਕੂਲ ਮੈਂ ਦੇਖਦੀ ਹਾਂ ਅਤੇ ਕਿਹੜੇ ਸਕੂਲ ਪੜ੍ਹਦੇ ਨੇ ਬੱਚੇ ਅੱਛਾ ਠੀਕ ਹੈ ਕਿਹੜੀ ਕਲਾਸ ਤੱਕ ਹੈਗਾ ਉਹ ਓਕੇ ਠੀਕ ਹੈ ਅਤੇ ਉਥੇ ਮੈਂ ਹਾਂਜੀ ਅਸੀਂ ਨਾ ਇੱਥੇ ਹੁਣ ਨਵਾਂ ਹੀ ਘਰ ਲਿੱਤਾ ਤੁਹਾਡੀ ਗਲੀ ਦੇ ਵਿੱਚ ਤੁਹਾਡੇ ਘਰ ਤੋਂ ਮਤਲਵ ਇੱਕ ਇੱਕ ਟਰਨ ਕਰੋ ਨਾ ਉੱਥੇ ਤਾਂ ਦੇਖਦੇ ਜੀ ਬੱਚੇ ਜਦੋਂ ਸਾਡੀ ਗਲੀ ਕ੍ਰੋਸ ਕਰਕੇ ਜਾਂਦੇ ਨਾ ਬਾਹਰ ਵੈਨ ਵਗੈਰਾ ਲੈਂਦੇ ਹੁੰਦੇ ਅੱਛੇ ਲੱਗਦਾ ਜੀ ਬੱਚੇ ਦੀ ਯੂਨੀਫੋਮ ਵਗੈਰਾ ਵੀ ਅੱਛੀ ਹੈ ਸਟਾਈਲ ਬੜਾ ਅੱਛਾ ਨਾਲੇ ਚੱਲਣ ਦਾ

ਸਿੱਖ ਇਤਿਹਾਸ ਤਾਂ ਮੇਰਾ ਖਿਆਲ ਇਕੱਲਾ ਗ ਅ ਗਰਲਜ਼ ਦਾ ਹੀ ਹੈਗਾ ਉਹ ਤਾਂ ਕੋਐਡ ਨਹੀਂ ਹੈ ਨਹੀਂ ਨਹੀਂ ਤਾਂ ਮੇਰਾ ਖਿਆਲ ਓਨਲੀ ਫਾਰ ਗਰਲਜ਼ ਹੈਗਾ ਨਾ ਓਕੇ ਓਕੇ ਠੀਕ ਹੈ ਨਹੀਂ ਮੇਰਾ ਤਾਂ ਬੇਟਾ ਹੈਗਾ ਬੇਟੇ ਨੂੰ ਪਾਉਣਾ ਹੈ ਵੈਸੇ ਤਾਂ ਕਰਕੇ ਗਰੀਨ ਡੇਲ ਮ ਮਹਿੰਗਾ ਨਹੀਂ ਹੈ ਹਰਕ੍ਰਿਸ਼ਨ ਨਾਲੋਂ ਮਹਿੰਗਾ ਹਾਂ

ਠੀਕ ਹੈ ਜੀ

ਠੀਕ ਹੈ ਅਤੇ ਜਿਸ ਤਰ੍ਹਾਂ ਹੁਣ ਅਸੀਂ ਇਨ ਬਿਟਵੀਨ ਪਾਉਣਾ ਵਾ ਤਾਂ ਐਡਮਿਸ਼ਨ ਮਿਲ ਜੇਗੀ ਨਹੀਂ ਕੋਈ ਡੋਨੇਸ਼ਨ ਵਗੈਰਾ ਤਾਂ ਨਹੀਂ ਲੈਂਦੇ ਠੀਕ ਹੈ ਕਿਉਂਕਿ ਸਾਡੀ ਵੀ ਪ੍ਰਾਈਵੇਟ ਜੋਬ ਹੀ ਹੈ ਨਾ ਅਤੇ ਫਿਰ ਤੁਹਾਨੂੰ ਪਤਾ ਹੀ ਕਿ ਅੱਜ ਕੱਲ੍ਹ ਖਰਚੇ ਕਿੰਨੇ ਹੀ ਹੈਗੇ ਆ ਤਾਂ ਅਤੇ ਜਿੱਥੇ ਅੱਛੀ ਐਜੂਕੇਸ਼ਨ ਮਿਲ ਜਾਵੇ ਤੁਹਾਨੂੰ ਉਹੀ ਬੈਟਰ ਹੈ ਸਸਤਾ ਵੀ ਹੋਵੇ ਅਤੇ ਵਧੀਆ ਵੀ ਹੋਵੇ ਜੀ ਹਾਂ ਹਾਂਜੀ ਹਾਂਜੀ ਇਹਦੀਆਂ ਤਾਂ ਸੁਣਿਆ ਮੈਂ ਕਾਫੀ ਬਰਾਂਚ ਨੇ ਨਾ ਅਤੇ ਤੁਹਾਡੇ ਬੱਚੇ ਕਿਹੜੀ ਵੈਨ 'ਚ ਜਾ ਰਹੇ ਨੇ ਠੀਕ ਹੈ ਚਲੋ ਫਿਰ ਮੈਂ ਕੱਲ੍ਹ ਟਰਾਈ ਕਰਦੀ ਹਾਂ ਅਤੇ ਪੁੱਛ ਕੇ ਆਉਂਦੀ ਹਾਂ ਸਾਰਾ

ਜੇ ਤੁਹਾਨੂੰ ਜਾਣਾ ਪਏਗਾ ਨਾਲ ਤੁਸੀਂ ਜਾ ਸਕਦੇ ਹੋ ਨਾ ਠੀਕ ਹੈ ਠੀਕ ਥੈਂਕ ਯੂ ਜੀ ਥੈਂਕ ਯੂ ਠੀਕ ਹੈ ਜੀ ਠੀਕ